ਫਤਿਹਗੜ੍ਹ ਸਾਹਿਬ ਦੇ ਰਿਹਾਇਸ਼ੀ ਵਿਕਲਪ ਕਾਫੀ ਉਪਲਬਧ ਹਨ ਇਹ ਜਿਵੇਂ ਕਿ ਵਿਕਲਪ ਰਿਹਾਇਸ਼ੀ ਲਈ ਕਿਰਾਏ ਦ ਕਿਰਾਏ ਦੇ ਘਰ ਰਹਿਣ ਲਈ ਛੋਟੇ ਘਰ ਅਤੇ ਕਈ ਵੱਡੇ ਘਰ ਵੀ ਉਪਲਬਧ ਹਨ ਇਸ ਜ਼ਿਲ੍ਹੇ ਵਿੱਚ ਹਾਊਸਿੰਗ ਅਤੇ ਰੀਅਲ ਸਟੇਟ ਦੇ ਰੁਝਾਨ ਵੀ ਕਾਫੀ ਜ਼ਿਆਦਾ ਹਨ ਕਿਉਂਕਿ ਹਾਊਸਿੰਗ ਮਾਰਕੀਟ ਕਾਫੀ ਐਜੂਕੇਸ਼ਨ ਕਿਉਂਕਿ ਹੈਗੀ ਆ ਇਸ ਲਈ ਹਾਊਸਿੰਗ ਮਾਰਕੀਟ ਅਤੇ ਰੀਅਲ ਸਟੇਟ 'ਚ ਲੋਕਾਂ ਦੇ ਰੁਝਾਨ ਨੇ ਰੀਅਲ ਸਟੇਟ ਕੋਲ ਗੋਬਿੰਦਗੜ੍ਹ ਇੰਡਸਟਰੀਅਲ ਏਰੀਆ ਹੋਣ ਕਰਕੇ ਇਹ ਰੁਝਾਨ ਕਾਫੀ ਜ਼ਿਆਦਾ ਨੇ ਛੋਟੇ ਘਰਾਂ ਦਾ ਰੁ ਛੋਟੇ ਘਰਾਂ ਲਈ ਕਿਰਾਏ ਲਈ ਕਾਫੀ ਘ ਘਰ ਹਨ ਇਹ ਕਿਰਾਇਆ ਹਜ਼ਾਰ ਤੋਂ ਦੋ ਹਜ਼ਾਰ ਤਿੰਨ ਹਜ਼ਾਰ ਰੁਪਏ ਤੱਕ ਉਪਲਬਧ ਹਨ ਇੱਥੇ ਸਿ ਸਿੱਖਿਆ ਅਤੇ ਸਿੱਖਿਆ ਦੇ ਕੰਮ ਲਈ ਆਉਣ ਲਈ ਕਾਫੀ ਲੋਕਾਂ ਲਈ ਕਾਫੀ ਰਿਸਾ ਰਿਹਾਇਸ਼ੀ ਵਿਕਲਪ ਹਨ ਜਿਵੇਂ ਕਿ ਸਿੱਖਿਆ ਦਾ ਖੇਤਰ ਕਾਫੀ ਉੱਨਤ ਹੈ ਫਤਿਹਗੜ੍ਹ ਡਿਸਟ੍ਰਿਕ 'ਚ ਇੱਥੇ ਕਾਫੀ ਕੋਲਜ ਆਰਟਸ ਕੋਲਜ ਇੰਨਅਰਿੰਗ ਕੋਲਜ ਯੂਨੀਵਰਸਿਟੀ ਵਰਡ ਯੂਨੀਵਰਸਿਟੀ ਉਪਲਬਧ ਹਨ ਜਿੱਥੋਂ ਕਿ ਲੋਕ ਬੱਚੇ ਕ ਮੁੱਢਲੀ ਅਤੇ ਹਾਇਰ ਐਜੂਕੇਸ਼ਨ ਲੈ ਸਕਦੇ ਹਨ ਇਸ ਇੱਥੇ ਸਿੱਖਿਆ ਲਈ ਸਕੂਲ ਕਾਫੀ ਸਕੂਲ ਕੋਂਨਵੈਂਟ ਸਕੂਲ ਸਰਕਾਰੀ ਸਕੂਲ ਅਤੇ ਪ੍ਰਾਈਵੇਟ ਸਕੂਲ ਉਪਲਬਧ ਹਨ ਜਿਨ੍ਹਾਂ 'ਚ ਬੱਚੇ ਆਪਣੇ ਐਜੂਕੇਸ਼ਨ ਲੈ ਸਕਦੇ ਹਨ ਇਸ ਕਰਕੇ ਐਜੂਕੇਸ਼ਨ ਦੇ ਪਰਪਸ ਤੋਂ ਲੋਕਾਂ ਦਾ ਰਿਹਾਇਸ਼ੀ ਵਿ ਰਿਹਾਇਸ਼ੀ ਜ਼ਿਆਦਾ ਇੰਟਰਸ ਰੁਝਾਨ ਹੈ ਅਤੇ ਰੀਅਲ ਸਟੇਟ ਦੇ ਮਾਮਲੇ ਵਿੱਚ ਇੱਥੇ ਦੀ ਹਿਸਟੋਰੀਕਲ ਪਲੇਸ ਹੋਣ ਕਰਕੇ ਲੋਕਾਂ ਦਾ ਇੱਥੇ ਰੁਝਾਨ ਕਾਫੀ ਹੈ ਕਾਫੀ ਜ਼ਿਆਦਾ ਆਪਣੇ ਦ ਲੋਕ ਇੱਧਰ ਰੁਝਾਨ ਦਿਖਾਉਂਦੇ ਨੇ ਕਿਉਂਕਿ ਹਾਊਸਿੰਗ ਘਰ ਲੈਂਦੇ ਨੇ ਵ ਹਿਸਟੋਰੀਕਲ ਪਲੇਸ ਹੋਣ ਕਰਕੇ ਇਸ ਜਗ੍ਹਾ ਦਾ